ਇੱਕ ਇੱਕ ਉੱਨੀ ਸੌ ਛਪੰਜਾ ਸਤਾਰਾਂ ਦੋ ਉੱਨੀ ਸੌ ਛਿਆਸੀ ਵੀਹ ਦਸ ਉੱਨੀ ਸੌ ਸਤਾਸੀ ਸਤਾਰਾਂ ਨੌ ਉੱਨੀ ਸੌ ਚੌਂਹਠ ਵੀਹ ਦਸ ਉੱਨੀ ਸੌ ਸੰਤਾਲ਼ੀ